ਹੈਲੋ ਸਰ ਤੁਸੀਂ ਸਵੀਗੀ ਰੈਸਟੋਰੈਂਟ ਤੋਂ ਬੋਲ ਰਹੇ ਹੋ ਅਸੀਂ ਤੁਹਾਡੇ ਤੋਂ ਆਡਰ ਬੁੱਕ ਕਰਵਾਉਣਾ ਸੀ ਅਸੀਂ ਦੀਨਾਨਗਰ ਸਟੇਸ਼ਨ 'ਤੇ ਰੁਕੇ ਹੋਏ ਹਾਂ ਅਤੇ ਮੈਨੂੰ ਮੌਸਮ ਵੀ ਬਹੁਤ ਖ਼ਰਾਬ ਹੈ ਮੀਂਹ ਪੈ ਰਿਹਾ ਹੈ ਇਸ ਲਈ ਮੈਂ ਬਾਹਰ ਨਿਕਲ ਕੇ ਆਪਣਾ ਖਾਣਾ ਵੀ ਨਹੀਂ ਲਿਆ ਸਕਦਾ ਕਿਉਂਕਿ ਮੇਰੇ ਕੋਲ ਕੋਈ ਜ਼ਰੂਰੀ ਕਾਗਜ਼ਾਤ ਨੇ ਜੋ ਮੇਰੇ ਖ਼ਰਾਬ ਹੋ ਜਾਣਗੇ ਗਿੱਲੇ ਹੋ ਕੇ ਇਸ ਲਈ ਮੈਂ ਤੁਹਾਡੇ ਕੋਲੋਂ ਖਾਣਾ ਔਡਰ ਕਰਵਾਉਣਾ ਚਾਹੁੰਦਾ ਹੈ ਕੀ ਤੁਸੀਂ ਮੈਨੂੰ ਦੀਨਾਨਗਰ ਸਟੇਸ਼ਨ ਉੱਪਰ ਮੇਰੀ ਟਰੇਨ ਰੁਕੇਗੀ ਸੁਬਾਹ ਚਾਰ ਵਜੇ ਤੁਰੇਗੀ ਇਸ ਲਈ ਮੈਂ ਤੁਹਾਡੇ ਕੋਲੋਂ ਖਾਣਾ ਔਡਰ ਕਰਵਾ ਰਿਹਾ ਹੈ ਕੀ ਤੁਸੀਂ ਮੈਨੂੰ ਇਸ ਸਟੇਸ਼ਨ 'ਤੇ ਖਾਣਾ ਪਹੁੰਚਾ ਸਕਦੇ ਹੋ ਕਿਉਂਕਿ ਗੱਡੀ ਵਿੱਚ ਖਾਣਾ ਸਹੀ ਨਹੀਂ ਮਿਲਦਾ ਪੂਰਾ ਪੱਕਿਆ ਹੋਇਆ ਵੀ ਨਹੀਂ ਹੁੰਦਾ ਅਤੇ ਇਹ ਮਿਰਚ ਮਸਾਲੇ ਵੀ ਬਹੁਤ ਜ਼ਿਆਦਾ ਤੇਜ ਨੇ ਇਸ ਕਰਕੇ ਮੈਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਮੈਨੂੰ ਇੰਨਾ ਮਿਰਚਾਂ ਮਸਾਲਾ ਡਾਕਟਰ ਨੇ ਮਨਾ ਕੀਤਾ ਹੋਇਆ ਹੈ ਮੈਂ ਇਸ ਕਰਕੇ ਇਹ ਖਾਣਾ ਨਹੀਂ ਖਾ ਸਕਦਾ ਕਿਰਪਾ ਕਰਕੇ ਮੈਨੂੰ ਇੱਥੇ ਦੀਨਾਨਗਰ ਸਟੇਸ਼ਨ 'ਤੇ ਪਲੀਜ਼ ਖਾਣਾ ਪਹੁੰਚਾ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਜੇ ਤੁਸੀਂ ਮੈਨੂੰ ਇਹ ਖਾਣਾ ਪਹੁੰਚਾਓਗੇ ਤਾਂ